ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਔਲਾ ਐਪ ਤੋਂ ਕਾਂ ਗੱਲ ਕਰ ਰਹੇ ਹੋ ਸਰ ਹਾਂਜੀ ਮੈਂ ਸਰ ਕੱਲ੍ਹ ਆਪਣੀ ਐਪਲੀਕੇਸ਼ਨ ਔਲਾ ਤੋਂ ਇੱਕ ਔਡਰ ਕੀਤਾ ਸੀਗਾ ਆਪਣੀ ਗੱਡੀ ਬੁੱਕ ਕਰਵਾਈ ਸੀਗੀ ਜੋ ਮੈਂ ਚੰਡੀਗੜ੍ਹ ਜਾਣਾ ਸੀਗਾ ਬਠਿੰਡੇ ਤੋਂ ਸਰ ਮੈਂ ਬਠਿੰਡੇ ਦਾ ਵਸਨੀਕ ਹਾਂ ਅਤੇ ਬਠਿੰਡੇ ਤੋਂ ਮੈਂ ਚੰਡੀਗੜ੍ਹ ਜਾਣਾ ਸੀ ਜਿਹਦੇ ਵਿੱਚ ਮੈਂ ਤਿੰਨ ਹਜ਼ਾਰ ਰੁਪਈਆ ਤੁਹਾਨੂੰ ਇਸ ਐਪਲੀਕੇਸ਼ਨ ਦੇ ਵਿੱਚ ਪਹਿਲਾਂ ਡਲੀਵਰੀ ਦਾ ਦਿੱਤਾ ਸੀਗਾ ਸੋ ਮੇਰਾ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਅਚਾਨਕ ਬਿਮਾਰ ਹੋ ਗਿਆ ਜੋ ਕਿ ਮੇਰੇ ਚਾਚਾ ਜੀ ਲੱਗਦੇ ਨੇ ਅਤੇ ਉਹਦਾ ਕਰਕੇ ਮੈਂ ਇਹ ਔਡਰ ਕੈਂਸਲ ਕਰਨਾ ਗਾ ਜੀ ਅਤੇ ਇਹ ਕੈਂ ਇਹ ਰੱਦ ਕਰਨ ਵਾਸਤੇ ਔਡਰ ਨੂੰ ਮੈਨੂੰ ਕੀ ਕਰਨਾ ਪਊਗਾ ਜੀ ਸਰ ਮੇਰਾ ਸੀਗਾ ਦਸ ਵਜੇ ਦਾ ਟੈਮ ਸੀਗਾ ਜਾਣ ਦਾ ਅਤੇ ਦਸ ਤੋਂ ਮੈਂ ਹਾਂਜੀ ਵਾਪਸ ਵੀ ਮੈਂ ਇਸ ਗੱਡੀ 'ਤੇ ਆਉਣਾ ਸੀ ਮੈਂ ਤਿੰਨ ਹਜ਼ਾਰ ਰੁਪਈਆ ਇਸ ਕਰਕੇ ਕੀਤਾ ਸੀ ਸੋ ਸਰ ਹੁਣ ਮੇਰੇ ਤੋਂ ਜਾਇਆ ਨਹੀਂ ਜਾਣਾ ਕਿਉਂਕਿ ਚਾਚਾ ਜੀ ਦੀ ਡੈਥ ਹੋ ਗਈ ਅਤੇ ਮੈਂ ਔਡਰ ਨੂੰ ਕੈਂਸਲ ਕਰਨਾ ਚਾਹੁੰਦਾ ਗਾ ਅਤੇ ਉਹ ਜਿਹੜੀ ਮੈਂ ਤੁਹਾਨੂੰ ਮਨੀ ਟ੍ਰਾਂਸਫਰ ਕੀਤੀ ਹੈ ਪੈਸੇ ਟ੍ਰਾਂਸਫਰ ਕੀਤੇ ਜੋ ਉਹ ਵਾਪਸ ਲੈਣਾ ਚਾਹੁੰਦਾ ਗਾ ਉਹ ਕਿੱਦਾਂ ਆਣਗੇ ਜੀ ਹਾਂਜੀ ਸਰ ਕਿੰਨੇ ਟੈਮ ਦੇ ਵਿੱਚ ਆਉਣਗੇ ਉਹ ਪੈਸੇ ਫਿਰ ਪੂਰੀ ਅਮਾਊਂਟ ਆ ਜੂਗੀ ਜੀ ਮੇਰੇ ਮੇਰੇ ਅਕਾਊਂਟ ਦੇ ਵਿੱਚ ਆਊਗੀ ਠੀਕ ਹੈ ਜੀ ਤੁਹਾਡੀ ਬਹੁਤ ਕਿਰਪਾ ਹੋਊਗੀ ਬਹੁਤ ਮਿਹਰਬਾਨੀ ਹੋਊਗੀ ਜੀ ਕਹਿ ਕਹਿਣ ਦਾ ਮਤਲਬ ਮੈਂ ਜਾਣਾ ਤਾਂ ਸੀ ਪਰ ਇਸ ਕਾਰਨ ਦੇ ਕਰਕੇ ਮੈਂ ਨਹੀਂ ਜਾ ਸਕਦਾ ਸੋ ਮੈਨੂੰ ਇਹ ਜਿਹੜੀ ਮੇਰੀ ਅਮਾਊਂਟ ਆ ਇਹ ਵਾਪਸ ਕੀਤੀ ਜਾਵੇ ਅਤੇ ਇਹਦੇ ਵਿੱਚ ਇਹ ਵੀ ਗੱਲ ਆ ਮੈਨੂੰ ਸਰਵਿਸ ਦਾ ਵੀ ਤੁਹਾਡੀ ਦਾ ਪਤਾ ਸਰ ਬਹੁਤ ਵਧੀਆ ਸਰਵਿਸ ਆ ਤੁਹਾਡੀ ਸੋ ਮੈਨੂੰ ਉਮੀਦ ਆ ਕਿ ਤੁਸੀਂ ਮੈਨੂੰ ਘੰਟੇ ਡੇਢ ਘੰਟੇ ਵਿੱਚ ਸੋ ਮੈਨੂੰ ਪੈਸਿਆਂ ਦੀ ਲੋੜ ਵੀ ਸੀਗੀ ਅਤੇ ਘੰਟੇ ਦੋ ਘੰਟਿਆਂ ਵਿੱਚ ਇਹ ਮੈਨੂੰ ਮੇਰੇ ਪੈਸੇ ਵਾਪਸ ਕੀਤੇ ਜਾਣ